ਹਾਂਜੀ ਜੇ ਆਪਾਂ ਗੱਲ ਕਰੀਏ ਮੌਸਮ ਦੀ ਤਾਂ ਮੌਸਮ 'ਤੇ ਖੇਤੀ ਪੂਰੀ ਤਰ੍ਹਾਂ ਨਿਰਭਰ ਹੈ ਜਿਵੇਂ ਕਿ ਕਣਕ ਦੀ ਫਸਲ ਹੈ ਕਣਕ ਦੀ ਫਸਲ ਲਈ ਮੀਂਹ ਦੀ ਬਹੁਤ ਜ਼ਿਆਦਾ ਘੱਟ ਲੋੜ ਪੈਂਦੀ ਹੈ ਪਰ ਜੇ ਕਈ ਵਾਰ ਫਸਲ ਪੱਕੀ ਹੋਣ ਦੇ ਬਾਅਦ ਮੀਂਹ ਪੈ ਜਾਵੇ ਤਾਂ ਸਾਰੀ ਫਸਲ ਨਸ਼ਟ ਹੋਣ ਦਾ ਡਰ ਬਣਿਆ ਰਹਿੰਦਾ ਹੈ ਉਵੇਂ ਹੀ ਜੀਰੀ ਦੀ ਫਸਲ ਵਾਸਤੇ ਜੀਰੀ ਦੀ ਫਸਲ ਵਾਸਤੇ ਮੀਂਹ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਪਰ ਉਸ ਟਾਈਮ ਕਈ ਵਾਰ ਮੌਸਮ ਦੇ ਤਬਦੀਲੀ ਹੋਣ ਕਰਕੇ ਗਰਮੀ ਜ਼ਿਆਦਾ ਪੈਂਦੀ ਹੈ ਉੱਧਰੋਂ ਲਾਈਟ ਨਹੀਂ ਆਉਂਦੀ ਹੈ ਨਾ ਹੀ ਮੀਂਹ ਪੈਂਦਾ ਹੈ ਇਸ ਨਾਲ ਵੀ ਫਸਲ ਦਾ ਨਸ਼ਟ ਹੋਣ ਦਾ ਡਰ ਬਣਿਆ ਰਹਿੰਦਾ ਹੈ ਸਰਕਾਰਾਂ ਨੂੰ ਇਸ ਪ੍ਰਤੀ ਕੋਈ ਅਣਗੋਲਿਆ ਬਿਲਕੁਲ ਜ ਬਿਲਕੁਲ ਨਾਮਾਤਰ ਦਾ ਹੀ ਧਿਆਨ ਦੇ ਰਹੀਆਂ ਹਨ ਵੀ ਉਹਨਾਂ ਨੂੰ ਸਟੋਰੇਜ ਕਿਵੇਂ ਕਰਿਆ ਜਾਵੇ ਕਿਵੇਂ ਸਾਂਭ ਸੰਭਾਲ ਰੱਖੀ ਜਾਵੇ ਨਾ ਹੀ ਕੋਈ ਸਰਕਾਰੀ ਗੋਦਾਮ ਹਨ ਜਿਨ੍ਹਾਂ ਵਿੱਚ ਕਿਸਾਨ ਆਪਣੀਆਂ ਜਾ ਕੇ ਫਸਲਾਂ ਨੂੰ ਸਟੋਰ ਕਰ ਸਕਣ ਇਸ ਨੂੰ ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ